ਸਕੂਲਾਂ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਕਾਰ ਬੱਚਿਆਂ ਨੂੰ ਬੜਾ ਉਤਸਾਹਿਤ ਕਰਦੀ ਹੈ ਜਿਵੇਂ ਸਰਕਾਰ ਨੇ ਅੱਜ ਕੱਲ੍ਹ ਸਪੋਰਟਸ ਕੋਟਾ ਰੱਖ ਦਿੱਤਾ ਹੈ ਕਿ ਜੇ ਤੁਸੀਂ ਹਾਇਰ ਐਜੂਕੇਸ਼ਨ ਕਰਨੀ ਹੈ ਤਾਂ ਸਪੋਰਟਸ ਕੋਟਾ ਤੁਹਾਨੂੰ ਮਿਲੇਗਾ ਕਿ ਜੇ ਤੁਸੀਂ ਸਪੋਰਟਸ 'ਚ ਕੋਈ ਡਿਸਟ੍ਰਿਕਟ ਲੈਵਲ ਖੇਡਿਆ ਹੋਇਆ ਜਾਂ ਸਟੇਟ ਲੈਵਲ ਜੇ ਤੁਸੀਂ ਕੁਝ ਖੇਡਿਆ ਹੋਇਆ ਤਾਂ ਤੁਹਾਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਤਾਂ ਸਰਕਾਰ ਆਪਦੇ ਜਨੋ ਬੱਚਿਆਂ ਨੂੰ ਇਹ ਉਤਸ਼ਾਹਿਤ ਕਰਦੀ ਹੈਗੀ ਤੁਸੀਂ ਭਾ ਭਾਗ ਲਓ ਤਾਂ ਕਿ ਬੱਚੇ ਫਿੱਟ ਵੀ ਰਹਿਣ ਅੱਜ ਕੱਲ੍ਹ ਇੰਨਾਂ ਪੜ੍ਹਾਈ ਨੂੰ ਤਵੱਜਾ ਦਿੱਤੀ ਜਾਂਦੀ ਹੈ ਕਿ ਲੋਕ ਬੱਚੇ ਖੇਲਣਾ ਭੁੱਲ ਹੀ ਗਏ ਹਨ ਜੇ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ ਤਾਂ ਖੇਡਾਂ ਬੜਾ ਖੇਡਾ ਬੜੀਆਂ ਇੰਪੋਰਟੈਂਟ ਸੀ ਅਸੀਂ ਬਾਹਰ ਗਲੀ 'ਚ ਖੜ੍ਹ ਕੇ ਖੇਡਾਂ ਖੇਡਦੇ ਸੀ ਪਰ ਬੱਚੇ ਖੇਡਾਂ ਨੂੰ ਘੱਟ ਤਵੱਜੋ ਦਿੰਦੇ ਹਨ ਅਤੇ ਪਰ ਜੇ ਅੱਜ ਕੱਲ੍ਹ ਸਰਕਾਰ ਜੇ ਉਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਬੱਚੇ ਵੀ ਇਸ ਕੇਸ 'ਚ ਕੀ ਜੇ ਮੈਂ ਸਪੋਰਟਸ ਵੀ ਅੱਗੇ ਜਾਊਂਗਾ ਤਾਂ ਵੀ ਮੈਨੂੰ ਐਡਮਿਸ਼ਨ ਮਿਲ ਜਾਊਗੀ ਤਾਂ ਉਹ ਸਪੋਰਟਸ 'ਚ ਹਿੱਸਾ ਲੈਂਦੇ ਆ ਅਤੇ ਇਹਦੇ ਵਿੱਚ ਮਾਪੇ ਵੀ ਬੜੀ ਅਹਿਮ ਭੂਮਿਕਾ ਨਿਭਾ ਸਕਦੇ ਹੈ ਕਿਉਂਕਿ ਬੱਚਿਆਂ ਨੂੰ ਫਿਰ ਹੁੰਦਾ ਹੈ ਕਿ ਮਾਪਿਆਂ ਨੂੰ ਹੁੰਦਾ ਮਾਪਿਆਂ ਨੂੰ ਹੋਣਾ ਚਾਹੀਦਾ ਹੈ ਕਿ ਸਾਡੇ ਬੱਚੇ ਵੀ ਕਿਸੇ 'ਚ ਹਿੱਸਾ ਲੈਣ ਜੇ ਮਾਪੇ ਬੱਚਿਆਂ ਨੂੰ ਉਤਸਾਹਿਤ ਕਰਨਗੇ ਤਾਂ ਬੱਚੇ ਵੀ ਬੜੇ ਖੁਸ਼ ਹੋ ਕੇ ਹਿੱਸਾ ਲੈਣਗੇ ਬੱਚੇ ਮਾਪਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜੇ ਖੇਡਣਗੇ ਤਾਂ ਹੀ ਵਧੀਆ ਨੰਬਰ ਵੀ ਲੈ ਸਕਦੇ ਹੈ ਅਤੇ ਉਹਨਾਂ ਦੀ ਸਿਹਤ ਵੀ ਵਧੀਆ ਰਹੇਗੀ ਅਤੇ ਅੱਗੇ ਜਾ ਕੇ ਉਹਨਾਂ ਨੂੰ ਐਡਮਿਸ਼ਨ 'ਚ ਵੀ ਫਾਇਦਾ ਮਿਲੇਗਾ ਥੈਂਕ ਯੂ